ਹਾਂਜੀ ਮੈਂ ਸ਼ਿਵ ਸ਼ਕਤੀ ਹੋਟਲ ਦੇ ਵਿੱਚੋਂ ਕੁਝ ਸਬਜ਼ੀਆਂ ਅਤੇ ਕੁਝ ਮਿਠਾਈਆਂ ਅਤੇ ਹੋਰ ਵਸਤੂਆਂ ਖਾਣ ਵਾਸਤੇ ਮੰਗਵਾਈਆਂ ਸੀ ਸਵ ਮਿਠਾਈਆਂ ਤਾਂ ਬਹੁਤ ਵਧੀਆ ਸਨ ਅਤੇ ਜੋ ਸਬਜ਼ੀਆਂ ਸੀ ਉਹ ਬਹੁਤ ਹੀ ਖਰਾਬ ਸਨ ਸਬਜ਼ੀਆਂ ਦੇ ਵਿੱਚ ਮੈਂ ਮਟਰ ਪਨੀਰ ਸ਼ਾਹੀ ਪਨੀਰ ਕੜਾਹੀ ਪਨੀਰ ਮੇਕ ਮਿਕਸ ਵੈੱਜ ਆਦਿ ਮੰਗਵਾਈਆਂ ਸੀ ਸਬਜ਼ੀਆਂ ਦੇ ਵਿੱਚ ਨਮਕ ਬਹੁਤ ਹੀ ਜ਼ਿਆਦਾ ਸੀ ਸਬਜ਼ੀਆਂ ਖਾਣ ਨੂੰ ਬਿਲਕੁਲ ਹੀ ਵਧੀਆ ਨਹੀਂ ਸਨ ਅਤੇ ਬਿਲਕੁਲ ਹੀ ਬੇਸਵਾਦੀਆਂ ਸੀ ਮੈਂ ਇਹ ਸਬਜ਼ੀਆਂ ਨੂੰ ਵਾਪਸ ਕਰਨਾ ਚਾਹੁੰਦਾ ਹਾਂ ਤੁਸੀਂ ਮੈਨੂੰ ਵਾਪਸ ਕਰਨ ਦੀ ਨੀਤੀ ਬਾਰੇ ਦੱਸੋ ਤਾਂ ਜੋ ਮੈਂ ਇਹ ਸਬਜ਼ੀਆਂ ਤੁਹਾਨੂੰ ਵਾਪਸ ਕਰ ਸਕਾਂ ਸਬਜ਼ੀਆਂ ਦੇ ਵਿੱਚ ਜੋ ਕੜਾਹੀ ਪਨੀਰ ਸੀ ਉਸਦੇ ਵਿੱਚ ਨਮਕ ਅਤੇ ਹੋਰ ਮਸਾਲੇ ਬਹੁਤ ਹੀ ਜ਼ਿਆਦਾ ਸਨ ਸਬਜ਼ੀਆਂ ਬਿਲਕੁਲ ਹੀ ਖਾਣ ਨੂੰ ਠੀਕ ਨਹੀਂ ਸਨ ਇਸ ਲਈ ਮੈਂ ਇਹਨਾਂ ਨੂੰ ਵਾਪਸ ਕਰਨਾ ਚਾਹੁੰਦਾ ਹਾਂ ਮੈਂ ਸ਼ਿਵ ਮੈਂ ਸ਼ਿਵ ਸ਼ਕਤੀ ਹੋਟਲ ਨੂੰ ਏ ਇਹ ਬੇਨਤੀ ਕਰਦਾ ਹਾਂ ਕਿ ਮੈਨੂੰ ਤੁਸੀਂ ਆਪਣੀ ਵਾਪਸ ਕਰਨ ਦੀ ਨੀਤੀ ਬਾਰੇ ਜ਼ਰੂਰ ਦੱਸੋ ਤਾਂ ਜੋ ਮੈਂ ਸਮੇਂ ਸਿਰ ਸਬ ਇਹ ਸਬਜ਼ੀਆਂ ਤੁਹਾਨੂੰ ਵਾਪਸ ਕਰ ਸਕਾਂ